ਬੱਚੇ ਆਪਣੇ ਮਨੋਰੰਜਨ ਲਈ ਆਪਣੇ ਖ਼ਾਲੀ ਸਮੇਂ ਵਿੱਚ ਜ਼ਿਆਦਾਤਰ ਤਾਂ ਖੇਡਦੇ ਹੀ ਹਨ ਅਤੇ ਕਈ ਟੀ ਵੀ ਦੇ ਸ਼ੌਕੀਨ ਹੁੰਦੇ ਹਨ ਅਤੇ ਉਹ ਟੀ ਵੀ ਦੇਖਦੇ ਹਨ ਅੱਜ ਕੱਲ੍ਹ ਨੌਰਮਲ ਬੱਚੇ ਜ਼ਿਆਦਾਤਰ ਮੋਬਾਈਲ ਚਲਾ ਕੇ ਖੁਸ਼ ਹਨ ਅਤੇ ਉਹ ਜ਼ਿਆਦਾਤਰ ਮੋਬਾਈਲ ਵਿੱਚ ਗੇਮਾਂ ਵੀਡੀਓਆਂ ਅਜਿਹੀਆਂ ਚੀਜ਼ਾਂ ਦੇਖਣ ਵਿੱਚ ਜ਼ਿਆਦਾ ਰੂਚੀ ਰੱਖਦੇ ਹਨ ਅਤੇ ਖੇਡਣ ਵਿੱਚ ਜ਼ਿਆਦਾਤਰ ਬਹੁਤ ਘੱਟ ਅੱਜ ਕੱਲ੍ਹ ਬੱਚੇ ਜਾ ਰਹੇ ਹਨ ਕਿ ਉਹਨਾਂ ਨੂੰ ਫ਼ੋਨਾਂ ਵਿੱਚ ਅਜਿਹਾ ਕੁਝ ਮਿਲ ਜਾਂਦਾ ਹੈ ਜਿਹੜਾ ਕਿ ਉਹ ਆਪਣਾ ਫ਼ੋਨ ਵਿੱਚ ਹੀ ਦੇਖ ਕੇ ਮਨੋਰੰਜਨ ਕਰ ਸਕਦੇ